ਬੈਂਕਿੰਗ ਅਤੇ ਬੀਮਾ ਵਿੱਚ ਦੋਵੇਂ ਹੀ ਆਪਣੀ ਆਪਣੀ ਜਗ੍ਹਾ 'ਤੇ ਠੀਕ ਹਨ ਬੈਂਕਿੰਗ ਵਿੱਚ ਅਸੀਂ ਆਪਣੇ ਪੈਸੇ ਨੂੰ ਜਿਸ ਤਰ੍ਹਾਂ ਮਰਜ਼ੀ ਕਢਵਾ ਸਕਦੇ ਹਾਂ ਅਤੇ ਜਮਾਂ ਵੀ ਜਦੋਂ ਮਰਜ਼ੀ ਕਰਵਾ ਸਕਦੇ ਹਾਂ ਜਦੋਂ ਵੀ ਸਾਨੂੰ ਕੋਈ ਲੋੜ ਹੁੰਦੀ ਹੈ ਬੈਂਕ ਵਿੱਚ ਖੁੱਲ੍ਹੇ ਖ਼ਾਤੇ ਵਿੱਚ ਵਿਆਜ ਘੱਟ ਹੁੰਦਾ ਹੈ ਪਰ ਕਈ ਤਰ੍ਹਾਂ ਦੀਆਂ ਐੱਫ ਡੀ ਆਰ ਡੀ ਹਨ ਜਿੱਥੇ ਵਿਆਜ ਜ਼ਿਆਦਾ ਮਿਲਦਾ ਹੈ ਇਨ੍ਹਾਂ ਨੂੰ ਅਸੀਂ ਜਦੋਂ ਮਰਜ਼ੀ ਤੁੜਵਾ ਕੇ ਵਰਤ ਸਕਦੇ ਹਾਂ ਇਸ ਲਈ ਲੋਕਾਂ ਦੀ ਦਿਲਚਸਪੀ ਬੈਂਕਾਂ ਵੱਲ ਜ਼ਿਆਦਾ ਹੈ ਬੀਮਿਆਂ ਦੇ ਵਿੱਚ ਵੀ ਕਾਫ਼ੀ ਫ਼ਾਇਦੇ ਹਨ

ਇਹਨਾਂ ਵਿੱਚ ਸਾਡੇ ਪੈਸੇ ਕੁਝ ਟਾਈਮ ਲਈ ਬੱਝ ਜਾਂਦੇ ਹਨ ਜਿਸ ਕਰਕੇ ਅਸੀਂ ਲੋੜ ਪੈਣ 'ਤੇ ਵਿਆਜ ਦੀ ਵਰਤੋਂ ਨਹੀਂ ਕਰ ਸਕਦੇ ਵੈਸੇ ਬੀਮਾ ਪੂਰਾ ਹੋਣ 'ਤੇ ਕਾਫ਼ੀ ਮੁਨਾਫ਼ਾ ਮਿਲਦਾ ਹੈ